ਹੈਲੋ ਹਾਂਜੀ ਗੁਡ ਈਵਨਿੰਗ ਸਰ ਹਾਂਜੀ ਚੇਤਨ ਸਰ ਬੋਲ ਰਹੇ ਹੋ ਹਾਂਜੀ ਹਾਂਜੀ ਸਰ ਤੁਸੀਂ ਮਿਊਜਿਕ ਸਿਖਾਉਂਦੇ ਹੋ ਹਾਂਜੀ ਸਰ ਮੈਨੂੰ ਨਾ ਮੇਰੀ ਫਰੈਂਡ ਨੇ ਰੈਫਰੈਂਸ ਦਿੱਤਾ ਸੀ ਤੁਹਾਡਾ ਅਤੇ ਤੁਸੀਂ ਬਹੁਤ ਅੱਛਾ ਸਿਖਾਉਂਦੇ ਹੋ ਮਿਊਜਿਕ ਹਾਂਜੀ ਮੇਰਾ ਹਰਜਿੰਦਰ ਕੌਰ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਸਰ ਮੈਂ ਗੱਲ ਕੀਤੀ ਸੀ ਸਰ ਐਕਚੁਲੀ ਨਾ ਮੈਨੂੰ ਪੰਜਾਬੀ ਜਾਂ ਫੋਕ ਇੰਸਟੂਮੈਂਟ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਮੈਂ ਕਾਫ਼ੀ ਟਾਈਮ ਤੋਂ ਲੱਭ ਰਹੀ ਸੀ ਵੀ ਅੱਛਾ ਮਿਊਜਿਕ ਟੀਚਰ ਮਿਲ ਜਾਵੇ ਮੈਨੂੰ ਅਤੇ ਮੇਰੀ ਫਰੈਂਡ ਨੇ ਮੈਨੂੰ ਰੈਫਰੈਂਸ ਦਿੱਤਾ ਵੀ ਕਹਿੰਦੇ ਵੀ ਚੇਤਨ ਸਰ ਬਹੁਤ ਵਧੀਆ ਕਰਵਾਉਂਦੇ ਹੈ ਨਹੀਂ ਸਰ ਮੈਂ ਮਾੜਾ ਮੋਟਾ ਗਾ ਲੈਂਦੀ ਹਾਂ ਪਰ ਮੈਨੂੰ ਵਜਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਪਰ ਕੁਛ ਪਰਮਿੰਦਰ ਕਰਕੇ ਵੀ ਮੈਨੂੰ ਇੱਦਾਂ ਹੋਇਆ ਵੀ ਮੈਂ ਵੀ ਸਿੱਖਾਂ ਅਤੇ ਸਰ ਮੈਨੂੰ ਨਾ ਜ਼ਿਆਦਾ ਸ਼ੌਂਕ ਹੈਗਾ ਵੀ ਮੈਂ ਤਬਲਾ ਜਾਂ ਤਬਲਾ ਸਿੱਖਾਂ ਹਾਂਜੀ ਢੋਲਕ ਵਗੈਰਾ ਹਾਂਜੀ ਅਤੇ ਸਰ ਹਾਂਜੀ ਹਾਂਜੀ ਸਰ ਫਰੈਸ਼ਰ ਹੀ ਹਾਂ ਹਜੇ ਤਾਂ ਅਤੇ ਹਾਂਜੀ ਅਤੇ ਤੁਸੀਂ ਦੱਸੋ ਮੈਂ ਸਿੱਖ ਪਾਊਂਗੀ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਸਰ ਮੈਂ ਦੇਖ ਲੈਂਦੀ ਹਾਂ ਮੈਂ ਜੋਬ ਵੀ ਕਰਦੀ ਹਾਂ ਤੇ ਸ਼ਾਮ ਦਾ ਹੀ ਟਾਈਮ ਠੀਕ ਰਹੇਗਾ ਹਾਂਜੀ ਹਾਂਜੀ ਅਤੇ ਸਰ ਇਹ ਕਿੰਨੇ ਟਾਈਮ ਤੱਕ ਮਤਲਬ ਮੈਂ ਸਿੱਖ ਪਾਊਂਗੀ ਕੋਈ ਟਾਈਮ ਪੀਰਡ ਮਹੀਨਾ ਦੋ ਮਹੀਨੇ ਚਾਰ ਮਹੀਨੇ ਛੇੇ ਮਹੀਨੇ ਠੀਕ ਹੈ ਠੀਕ ਹੈ ਸਰ ਅਤੇ ਸਰ ਆਪਣੀ ਚਾਰਜਸ ਵਗੈਰਾ ਕੀ ਹੈਗੇ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਸਰ ਡੇਲੀ ਕਲਾਸਿਸ ਹੋਣਗੀਆਂ ਜਾਂ ਵੀਕਲੀ ਹੋਣਗੀਆਂ ਓਕੇ ਓਕੇ ਠੀਕ ਹੈ ਸਰ ਠੀਕ ਹੈ ਜ਼ਰੂਰ ਹਾਂਜੀ ਅਤੇ ਸਰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਰ ਹੁੰਦੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਗੀ ਹਾਂਜੀ ਚਲੋ ਠੀਕ ਹੈ ਸਰ ਫਿਰ ਮੈਂ ਕੱਲ੍ਹ ਆ ਕੇ ਮਿਲਦੀ ਹਾਂ ਤੁਹਾਨੂੰ ਇਵਨਿੰਗ ਹੀ ਸਰ ਸੂਟ ਕਰੇਗਾ ਮੈਨੂੰ ਟਾਈਮ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਸਰ ਹਾਂਜੀ ਥੈਂਕ ਯੂ ਥੈਂਕ ਯੂ ਸਰ ਓਕੇ ਥੈਂਕ ਯੂ